ਕਈ ਸਾਲਾਂ ਤੋਂ ਖੇਤੀ ਬਹੁਤ ਬਦਲ ਚੁੱਕੀ ਹੈ ਇਸ ਖੇਤੀ ਵਿੱਚ ਤਾਂ ਐਨਾ ਜ਼ਿਆਦਾ ਬਦਲਾਅ ਆ ਚੁੱਕਿਆ ਹੈ ਕਿ ਹੁਣ ਖੇਤੀ ਕਰਨੀ ਔਖੀ ਨਹੀਂ ਲੱਗਦੀ ਕਿਉਂਕਿ ਖੇਤੀ ਕਰਨ ਲਈ ਲਈ ਤਾਂ ਮਸ਼ੀਨਰੀ ਬਹੁਤ ਜ਼ਿਆਦਾ ਵਧੀਆ ਬਣ ਚੁੱਕੀ ਹੈ ਜਿਵੇਂ ਟਰੈਕਟਰ ਆ ਚੁੱਕੇ ਨੇ ਅਤੇ ਰੂਟਾਵੀਟਰ ਆ ਚੁੱਕੇ ਨੇ ਉਹਨਾਂ ਨਾਲ ਬਿਜਾਈ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਅਤੇ ਕੰਬਾਈਨਾਂ ਨਾਲ ਫਸਲ ਜਲਦੀ ਵੱਢੀ ਜਾਂਦੀ ਹੈ ਜਲਦੀ ਹੋ ਜਾਂਦਾ ਸਾਰਾ ਕੰਮ ਛੇਤੀ ਛੇਤੀ ਕਿਸਾਨ ਫਸਲ ਵਟਾ ਕੇ ਆਪਣਾ ਕੰਮ ਫਸਲ ਤਿਆਰ ਕਰ ਦਿੰਦਾ ਹੈ ਅਤੇ ਇਸ ਇਹ ਖੇਤੀ ਤਾਂ ਕਰਨੀ ਬਹੁਤ ਜ਼ਿਆਦਾ ਸੌਖੀ ਹੈ ਕਿਉਂਕਿ ਸਾਧਨ ਤਕਨੀਕੀ ਨਵੀਂਆਂ ਨਵੀਆਂ ਤਕਨੀਕਾਂ ਨਾਲ ਖੇਤੀ ਕਰਨੀ ਐਨੀ ਜ਼ਿਆਦਾ ਵਧੀਆ ਹੋ ਗਈ ਹੈ ਜਿਵੇਂ ਹੁਣ ਸਪਰੇ ਕਰਨੀ ਸਪਰੇਹਾਂ ਮਤਲਬ ਪੰਪ ਵੱਡੇ ਵੱਡੇ ਪੰਪ ਵਗੈਰਾ ਆ ਗਏ ਨੇ ਉਹਨਾਂ ਨੂੰ ਪ੍ਰੈਸਰ ਨਾਲ ਪਾਈਪਾਂ ਨਾਲ ਲਾ ਕੇ ਸਪਰੇ ਕਰ ਦਿੱਤੀ ਜਾਂਦੀ ਆ ਕੁਝ ਘੰਟਿਆਂ ਮਿੰਟਾਂ ਵਿੱਚ ਐਨੇ ਜ਼ਿਆਦਾ ਕਿੱਲਿਆਂ ਨੂੰ ਸਪਰੇ ਕਰ ਦਿੱਤੀ ਜਾਂਦੀ ਹੈ ਤਾਂ ਸਮਾਂ ਬਹੁਤ ਜ਼ਿਆਦਾ ਘੱਟ ਲੱਗਣ ਲੱਗ ਗਿਆ ਜਲਦੀ ਕਿਸਾਨ ਦਾ ਕੰਮ ਨਿੱਬੜ ਜਾਂਦਾ ਹੈ ਅਤੇ ਖੇਤੀ ਵੀ ਮਤਲਬ ਕਿ ਹੋਰ ਚੀਜ਼ਾਂ ਵਾਂਗ ਫਾਸਟ ਹੋਣ ਲੱਗ ਗਈ ਅਤੇ ਜਿਹੜੀ ਰਵਾਇਤੀ ਖੇਤੀ ਸੀ ਪਹਿਲਾਂ ਵਾਲੀ ਖੇਤੀ ਉਹ ਜ਼ਿਆਦਾ ਔਖੀ ਸੀ ਉਹ ਬਹੁਤ ਕਿਸਾਨ ਨੂੰ ਐਨੀ ਜ਼ਿਆਦਾ ਬਜ਼ੁਰਗਾਂ ਨੂੰ ਮਿਹਨਤ ਕਰਨੀ ਪੈਂਦੀ ਸੀ ਕਿਉਂਕਿ ਖੇ ਇਸ ਉਸ ਖੇਤੀ ਵਿੱਚ ਮਤਲਬ ਕਿ ਉਹਦੇ ਨਾਲ ਹਲਾਂ ਨਾਲ ਵਾਹਿਆ ਜਾਂਦਾ ਸੀ ਕਿਸਾਨ ਨੂੰ ਆਪ ਖੁਦ ਹਲ ਚਲਾ ਕੇ ਵਾਹੁਣਾ ਪੈਂਦਾ ਸੀ ਬਲਦ ਜੋੜੇ ਹੁੰਦੇ ਸੀ ਉਹਨਾਂ ਨਾਲ ਹਲ ਚਲਾ ਕੇ ਬਲਦ ਵਾਹੁੰਦੇ ਸੀਗੇ ਖੂਹ ਹੁੰਦੇ ਸੀਗੇ ਉਹ ਖੂਹਾਂ ਦੇ ਵਿੱਚ ਬ ਉਹਨਾਂ ਨੂੰ ਬਲਦਾਂ ਬਲਦ ਆਲੇ ਮਤਲਬ ਗੇੜਾ ਕੱਢਦੇ ਸੀਗੇ ਉਹਨਾਂ ਦੇ ਉਹਨਾਂ ਨੂੰ ਗੇੜਾ ਕੱਢ ਕੇ ਪਾਣੀ ਲਿਆ ਜਾਂਦਾ ਸੀਗਾ ਤਾਂ ਅੱਜ ਕੱਲ੍ਹ ਤਾਂ ਐਨੇ ਵਧੀਆ ਮਸ਼ੀਨਾਂ ਨਾਲ ਬੋਰ ਕੀਤੇ ਜਾਂਦੇ ਨੇ ਵਧੀਆ ਪਾਇਪ ਪਾਏ ਜਾਂਦੇ ਨੇ ਅਤੇ ਐਨਾ ਵਧੀਆ ਵੱਧ ਤੋਂ ਵੱਧ ਪਾਣੀ ਕੱਢ ਲਿਆ ਜਾਂਦਾ ਡਿਲੀਵਰੀਆਂ ਪਾ ਕੇ ਅਤੇ ਪਹਿਲਾਂ ਪਾਣੀ ਲੈਣਾ ਵੀ ਬਲਦਾਂ ਨਾਲ ਹੀ ਹੁੰਦਾ ਸੀ ਅਤੇ ਉਹਨਾਂ ਨੂੰ ਖੇਤੀ ਕਰਨੀ ਬਹੁਤ ਜ਼ਿਆਦਾ ਔਖੀ ਸੀ ਬਹੁਤ ਜ਼ਿਆਦਾ ਔਖੀ ਸੀ ਅਤੇ ਮਿਹਨਤ ਬਹੁਤ ਜ਼ਿਆਦਾ ਕਰਨੀ ਪੈਂਦੀ ਸੀ ਅੱਜ ਕੱਲ੍ਹ ਤਾਂ ਬਹੁਤ ਜ਼ਿਆਦਾ ਸੌਖੀ ਹੈ ਖੇਤੀ ਕਰਨੀ ਨਵੇਂ ਨਵੇਂ ਤਕਨੀਕਾਂ ਨਾਲ ਖੇਤੀ ਕੀਤੀ ਜਾਂਦੀ ਹੈ ਢੰਗ ਨਾਲ ਪਹਿਲੀ ਅਤੇ ਹੁਣ ਵਾਲੀ ਖੇਤੀ ਵਿੱਚ ਬਹੁਤ ਜ਼ਿਆਦਾ ਫਰਕ ਹੈ